ਹੈਲੋ ਸਤਿ ਸ਼੍ਰੀ ਅਕਾਲ ਭੈਣ ਕਿਵੇਂ ਤੁਸੀਂ ਠੀਕ ਹੋ ਹਾਂ ਠੀਕ ਆ ਭੈਣੇ ਤੇ ਅੱਜ ਬੜੇ ਦਿਨਾਂ ਬਾਅਦ ਕਾਫੀ ਸਾਲ ਹੋ ਗਏ ਆਪਾਂ ਨੇ ਕਦੀ ਗੱਲ ਹੀ ਨਹੀਂ ਕੀਤੀ ਹੈ ਨਾ ਹਾਂਜੀ ਅੱਛਾ ਅੱਛਾ ਹਾਂ ਹਾਂ ਹੁਣ ਤਾਂ ਕਾਫੀ ਬਦਲਾਵ ਆ ਗਿਆ ਪਹਿਲਾਂ ਹੋਰ ਸੀ ਅੱਛਾ ਅੱਛਾ ਕੋਈ ਨੀ ਮੈਂ ਤੁਹਾਨੂੰ ਦੱਸ ਦਵਾਂਗੀ ਠੀਕ ਹੈ ਨਹੀਂ ਮੈਨੂੰ ਪਤਾ ਉੱਧਰ ਆਪਣੇ ਸਬਜ਼ੀ ਬੱਸ ਅੱਡੇ ਕੋਲ ਹੈਗੀ ਹੈ ਸਬਜ਼ੀ ਮੰਡੀ ਦੀ ਦੁਕਾਨ ਹੈਗੀ ਉੱਥੇ ਬਹੁਤ ਵਧੀਆ ਸਬਜ਼ੀਆਂ ਤਾਜ਼ੀਆਂ ਸਬਜ਼ੀਆਂ ਮਿਲਦੀਆਂ ਨੇ ਕਿਉਂਕਿ ਫੂਡ ਬਾਹਰ ਹੁੰਦੇ ਨੇ ਸਬਜ਼ੀ ਵਾਲੇ ਅੰਦਰ ਹੁੰਦੇ ਨੇ ਤੁਸੀਂ ਉਥੋਂ ਲੈ ਲਿਆ ਲੈ ਲੈਣਾ ਅਤੇ ਹੋਰ ਵੀ ਤੁਹਾਨੂੰ ਕੁਛ ਹੋਰ ਚਾਹੀਦਾ ਤਾਂ ਮੈਨੂੰ ਦੱਸ ਦਿਆ ਜੇ ਕੁਛ ਹੋਰ ਵੀ ਲੈਣਾ ਹੋਵੇ ਤੁਸੀਂ ਹਾਂਜੀ ਜੇ ਦੁੱਧ ਵਗੈਰਾ ਲੈਣਾ ਤਾਂ ਉਹ ਜਹਾਜ਼ ਚੋਂਕ ਤੋਂ ਮਿਲਦਾ ਹਾਂ ਅੱਛਾ ਅੱਛਾ ਹਾਂ ਠੀਕ ਹੈ ਹਾਂ ਮੈਂ ਵੀ ਉੱਥੇ ਹੀ ਸਬਜ਼ੀ ਮੰਡੀ ਤੋਂ ਲੈ ਕੇ ਆਉਣੇ ਅਤੇ ਆਜ਼ਾਦ ਚੋਂਕ ਤੋਂ ਮੈਂ ਇੱਥੇ ਦੁੱਧ ਲੈਂਦੀ ਹਾਂ ਪਨੀਰ ਵੀ ਉੱਥੋਂ ਹੀ ਲੈ ਲੈਂਦੇ ਹਾਂ ਅਸੀਂ ਉਹ ਉਹਨਾਂ ਦੇ ਬੜੇ ਵਧੀਆ ਫਰੈਸ਼ ਹੈਗਾ ਪਨੀਰ ਅਤੇ ਦੁੱਧ ਬਹੁਤ ਵਧੀਆ ਮਿਲਦਾ ਹਾਂ

ਉਹ ਠੀਕ ਹੈ ਹਾਂ ਮੈਂ ਤੁਹਾਨੂੰ ਕੋਈ ਨਹੀਂ ਤੁਸੀਂ ਮੈਨੂੰ ਦੱਸਿਆ ਜੇ ਮੈਂ ਮੇਨ ਬਾਜ਼ਾਰ ਹੈਗਾ ਅਤੇ ਉੱਥੇ ਬਹੁਤ ਵਧੀਆ ਸੂਟ ਮਿਲਦੇ ਨੇ ਹਾਂ ਜਿੱਥੇ ਆਪਾਂ ਤੁਹਾਨੂੰ ਯਾਦ ਹੋਏਗਾ ਆਪਾਂ ਜਿੱਥੇ ਗੋਲ ਗੱਪੇ ਖਾ ਕੇ ਆਉਂਦੇ ਸੀ ਉਹ ਮੇਨ ਬਾਜ਼ਾਰ ਹੈ ਨਾ ਉੱਧਰ ਵਾਲੇ ਪਾਸੇ ਅਤੇ ਤੁਸੀਂ ਹਾਂ ਤੇਅ ਤੁਸੀਂ ਉਹ ਵਾਲੇ ਬਾਜ਼ਾਰ ਵਿੱਚ ਬਹੁਤ ਵਧੀਆ ਸੂਟ ਮਿਲਦੇ ਨੇ ਅਤੇ ਉਹਨਾਂ ਦਾ ਰੇ ਹੋਲਸੇਲ ਦੁਕਾਨ ਹੈਗੀ ਰੇਟ ਵੀ ਬਹੁਤ ਵਧੀਆ ਉਹਨਾਂ ਦੇ ਸੂਟਾਂ ਦੇ ਅਤੇ ਮੈਂ ਉਥੋਂ ਹਾਂ ਅਤੇ ਜੇ ਕੰਬਲ ਵਗੈਰਾ ਲੈਣਾ ਤਾਂ ਉਹ ਚਰਨ ਦੀ ਹੱਟੀ ਹੈਗੀ ਉਥੋਂ ਕੰਬਲ ਵਗੈਰਾ ਬਹੁਤ ਵਧੀਆ ਮਿਲਦੇ ਨੇ ਅਤੇ ਸੂਟ ਕਿਉਂਕਿ ਵਰੀਆਂ ਦਾ ਸਮਾਨ ਵਗੈਰਾ ਸੂਟ ਵਗੈਰਾ ਲੈਣਾ ਤਾਂ ਉੱਥੇ ਮਿਲ ਜਾਂਦੇ ਨੇ ਬਹੁਤ ਵਧੀਆ ਅੱਛਾ ਅੱਛਾ ਹਾਂ ਕੋਈ ਨਹੀਂ ਮੈਂ ਚਲਣਾ ਚਲੀ ਜਾਵਾਂਗੀ ਹਾਂ ਅਤੇ ਹੋਰ ਹੋਰ ਤੁਸੀਂ ਕੁਛ ਲੈਣਾ ਹੋਵੇ ਤਾਂ ਮੈਨੂੰ ਦੱਸ ਦਿਆ ਜੇ ਫੋਨ ਕਰਕੇ

ਠੀਕ ਹੈ ਹੋਰ ਤੁਸੀਂ ਦੱਸੋ ਹੋਰ ਅੰਕਲ ਆਂਟੀ ਕਿਵੇਂ ਠੀਕ ਨੇ ਹੋਰ ਤੁਹਾਡੇ ਬੱਚੇ ਵਗੈਰਾ ਸਭ ਠੀਕ ਨੇ ਹਾਂ ਬਸ ਵਧੀਆ ਸਾਰੇ

ਹਾਂਜੀ ਕੋਈ ਨਹੀਂ ਭੈਣੇ ਆ ਜਾਵਾਂਗੇ ਅਤੇ ਹੋਰ ਤੁਹਾਡੀ ਜੋਬ ਕਿੱਥੇ ਲੱਗੀ ਹੈ ਵੀਰੇ ਦੀ ਅੱਛਾ ਅੱਛਾ ਖਾਲਸਾ ਗੁਰਦੁਆਰਾ ਵੀ ਆਪਣਾ ਬਹੁਤ ਵਧੀਆ ਉਹ ਵੀ ਬੜਾ ਮਸ਼ਹੂਰ ਹੈਗਾ ਤੁਸੀਂ ਉੱਥੇ ਵੀ ਕਦੀ ਆਉਣਾ ਹੋਇਆ ਤਾਂ ਆ ਜਾਇਆ ਸਾਰਾਗੜੀ ਹੋ ਗਿਆ ਅਤੇ ਹੁਸੈਨੀ ਵਾਲਾ ਬਾਰਡਰ ਹੋ ਗਿਆ ਆਪਣਾ ਉਹ ਵੀ ਬਹੁਤ ਵਧੀਆ ਜੇਕਰ ਤੁਸੀਂ ਜਾਣਾ ਹੋਵੇ ਤਾਂ ਤੁਸੀਂ ਕੋਈ ਨਹੀਂ ਵੇਖਿਆ ਜੇ ਛੁੱਟੀ ਵੇਲੇ ਆਪਾਂ ਇਕੱਠੇ ਚੱਲ ਪਾਵਾਂਗੇ ਆਪਾਂ ਚੱਲਾਂਗੇ ਹਾਂ ਫਰੀ ਹੋ ਜਾਓ ਨਾ ਤੁਸੀਂ ਜਿਵੇਂ ਤੁਹਾਡਾ ਸੈਟਿੰਗ ਘਰ ਦੀ ਹੋ ਜਾਏਗੀ ਨਾ ਤਾਂ ਫਿਰ ਆਪਾਂ ਚੱਲਾਂਗੇ ਫਰੀ ਹੋ ਕੇ ਠੀਕ ਹੈ ਜੀ ਔਰ ਧੰਨਵਾਦ ਜੀ ਠੀਕ ਹੈ